ਪਹਿਲੇ ਸਮੇਂ ਵਿੱਚ ਅਸੀਂ ਐਪਸ ਤੋਂ ਬਗੈਰ ਰਹਿ ਸਕਦੇ ਸੀ ਪਰ ਅੱਜ ਕੱਲ੍ਹ ਦੇ ਸਮੇਂ ਵਿੱਚ ਸਾਨੂੰ ਐਪਸ ਤੋਂ ਬਗੈਰ ਰਹਿਣਾ ਬਹੁਤ ਔਖਾ ਹੈ ਜਿਵੇਂ ਸਵੇਰੇ ਉੱਠਦੇ ਸਾਰ ਹੀ ਸਾਨੂੰ ਅਲਾਰਮ ਉਠਾਉਂਦਾ ਹੈ ਜ਼ਿਆਦਾਤਰ ਲੋਕਾਂ ਨੂੰ ਅੱਜ ਕੱਲ੍ਹ ਅਲਾਰਮ ਉਠਾਉਂਦਾ ਹੈ ਅਲਾਰਮ ਤੋਂ ਬਾਅਦ ਸਵੇਰੇ ਉੱਠਦੇ ਸਾਰ ਹੀ ਅਸੀਂ ਸਾਡਾ ਵਟਸਐਪ ਚੈੱਕ ਕਰਦੇ ਹਾਂ ਕਿ ਕੋਈ ਮੈਸੇਜ ਤਾਂ ਨਹੀਂ ਆਇਆ ਜ਼ਰੂਰੀ ਮੈਸਜ ਤਾਂ ਨਹੀਂ ਆਇਆ ਜਾਂ ਅਸੀਂ ਆਪਣਾ ਮੈਸੇਜ ਬਾਕਸ ਚੈਕ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਸ਼ਾਰਟਸ ਦੇਖਦੇ ਹਾਂ ਜਿਹਨੂੰ ਆਪਾਂ ਯੂਟੀਊਬ ਕਹੀਦਾ ਅੱਜ ਕੱਲ੍ਹ ਯੂਟਿਊਬ 'ਤੇ ਸ਼ਾਰਟਸ ਚੈੱਕ ਕਰਦੇ ਹਾਂ ਕਿ ਕੁਛ ਇਮਪੋਰਟੈਂਟ ਨਿਊਜ਼ ਜਾਂ ਕੁਛ ਇਹੋ ਜਿਹਾ ਫੈਕਟ ਜਿਹੜਾ ਸਾਨੂੰ ਨਹੀਂ ਪਤਾ ਹੈ ਨਾ ਉਸ ਬਾਰੇ ਅਸੀਂ ਦੇਖਦੇ ਹਾਂ ਉਸ ਤੋਂ ਬਾਅਦ ਅਸੀਂ ਗੂਗਲ ਖੋਲ੍ਹ ਲੈਂਦੇ ਹਾਂ ਜਿਹਦੇ 'ਚ ਅਸੀਂ ਅੱਜ ਅੱਜ ਦਾ ਮੌਸਮ ਜਾਂ ਨਿਊਜ਼ਜ਼ ਨਿਊਜ਼ ਹੈਡਲਾਈਨ ਵਗੈਰਾ ਦੇਖਦੇ ਹਾਂ ਅਸੀਂ ਦੇਖ ਸਕਦੇ ਹਾਂ ਕਿ ਵਟਸਐਪ 'ਤੇ ਅੱਜ ਕੱਲ੍ਹ ਸਾਰੇ ਸੰਯੁਕਤ ਹੋ ਗਏ ਵਟਸਐਪ ਜਿਹੜਾ ਹੈਗਾ ਉਹਦੇ 'ਚ ਅੱਜ ਕੱਲ੍ਹ ਗਰੁੱਪ ਬਣੇ ਹੋਏ ਹਨ ਜਿਨ੍ਹਾਂ ਵਿੱਚ ਹੀ ਲੋਕ ਦੂਰ ਦੂਰ ਤੋਂ ਬਹਿ ਕੇ ਚੈਟ ਕਰ ਲੈਂਦੇ ਸੀ ਪਰ ਪਹਿਲੇ ਦੇ ਸਮੇਂ 'ਚ ਲੋਕ ਇਸ ਨੂੰ ਤਰਸਦੇ ਸਨ ਲੋਕ ਦੂਰ ਬੈਠੇ ਹੀ ਵੀਡੀਓ ਕਾਲ ਕਰ ਲੈਂਦੇ ਹਨ ਹੈ ਨਾ ਜਿਵੇਂ ਅਸੀਂ ਬਾਹਰ ਸੱਤ ਸਮੁੰਦਰੋਂ ਪਾਰ ਬੈਠੇ ਨਾਲ ਵੀਡੀਓ ਕਾਲ 'ਤੇ ਗੱਲ ਕਰ ਸਕਦੇ ਹਾਂ ਪਹਿਲਾਂ ਇਹ ਸੰਭਵ ਨਹੀਂ ਸੀ ਫਿਰ ਜੇ ਅਸੀਂ ਕਿਸੇ ਵੱਡੀ ਸ਼ਖਸ਼ੀਅਤ ਨੂੰ ਜਾਂ ਫਿਲਮ ਸਟਾਰ ਨੂੰ ਫੋਲੋ ਕਰਨਾ ਜਾਂ ਉਹਦੇ ਬਾਰੇ ਜਾਣਨਾ ਅਸੀਂ ਟਵੀਟਰ 'ਤੇ ਉਹਨੂੰ ਫੋਲੋ ਕਰਦੇ ਹਾਂ ਉਹਦੇ ਨਿਊਜ਼ ਪੜ੍ਹਦੇ ਹਾਂ ਉਹਦੇ ਬਾਰੇ ਜਾਣਦੇ ਹਾਂ ਕਿ ਲਿਖਦਾ ਕੀ ਕਰਦਾ ਪਿਆ ਪਰ ਜੇ ਅਸੀਂ ਉਹਦੇ ਬਾਰੇ ਨੋਲੇਜ ਲੈਣੀ ਹੈ ਫਿਰ ਅਸੀਂ ਵਿਕੀਪੀਡੀਆ ਖੋਲ੍ਹ ਸਕਦੇ ਹਾਂ ਕਿ ਵਿਕੀਪੀਡੀਆ ਸਾਨੂੰ ਉਸ ਬਾਰੇ ਸਾਰੀ ਨਾਲੇਜ ਦੇ ਦਿੰਦਾ ਲਾਸਟ ਵਿੱਚ ਡੀਜੀਲੋਕਰ ਦੀ ਗੱਲ ਹੈ ਕਿ ਡੀਜੀਲੋਕਰ ਇਹੋ ਜਿਹੇ ਐਪ ਹੈ ਕਿ ਜਿਹੜੇ ਸਾਨੂੰ ਸਾਰੇ ਸਾਡੇ ਜ਼ਰੂਰੀ ਕਾਗਜਾਤ ਇੱਕ ਹੀ ਐਪ ਵਿੱਚ ਦੇ ਦਿੰਦਾ ਹੈ ਚਾਹੇ ਉਹ ਜਾਤੀ ਸਰਟੀਫਿਕੇਟ ਹੋਵੇ ਚਾਹੇ ਉਹ ਰਿਹਾਇਸ਼ੀ ਹੋਵੇ ਚਾਹੇ ਉਹ ਆਧਾਰ ਕਾਰਡ ਹੋਵੇ ਚਾਹੇ ਤੁਹਾਡਾ ਪੈਨ ਕਾਰਡ ਹੋਵੇ ਇਸ ਕਰਕੇ ਅੱਜ ਕੱਲ੍ਹ ਦੀ ਜ਼ਿੰਦਗੀ ਵਿੱਚ ਇਹ ਬਹੁਤ ਜ਼ਰੂਰੀ ਚੀਜ਼ ਬਣ ਗਈ ਹੋਈ ਹੈ